ਖਾਣ ਪੀਣ ਲਈ ਮਨਪਸੰਦ ਚੀਜ਼ਾਂ ਮੇਰੀਆਂ ਬਹੁਤ ਨੇ ਗਰਮੀਆਂ ਦੇ ਵਿੱਚ ਮੁਸ਼ਕਿਲ ਆਉਂਦੀ ਆ ਕਿਉਂਕਿ ਗਰਮੀਆਂ ਦੇ ਵਿੱਚ ਖਾਣ ਪੀਣ ਲਈ ਸਬਜ਼ੀਆਂ ਘੱਟ ਹੁੰਦੀਆਂ ਨੇ ਸਰਦੀਆਂ ਦੇ ਵਿੱਚ ਇੱਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਸਰਦੀਆਂ ਦੇ ਵਿੱਚ ਹਰੀਆਂ ਸਬਜ਼ੀਆਂ ਬਹੁਤ ਹੁੰਦੀਆਂ ਨੇ ਜਿਵੇਂ ਕਿ ਤੁਸੀਂ ਕੁਛ ਵੀ ਖਾ ਸਕਦੇ ਹੋ ਤੁਸੀਂ ਮੇਥੇ ਦੀ ਭੁਰਜੀ ਬਣਾ ਕੇ ਖਾ ਸਕਦੇ ਹੋ ਆਲੂ ਮਟਰ ਖਾ ਸਕਦੇ ਹੋ ਆਲੂ ਗਾਜਰ ਖਾ ਸਕਦੇ ਹੋ ਆਲੂ ਗਾਜਰ ਮਟਰ ਇਕੱਠੇ ਖਾ ਸਕਦੇ ਹੋ ਠੀਕ ਹੈ ਜੀ ਅਤੇ ਮੇਥੇ ਦੇ ਪਰੌਂਠੇ ਬਣਾ ਸਕਦੇ ਹੋ ਸਰਦੀਆਂ ਦੇ ਵਿੱਚ ਹਰੀ ਸਬਜ਼ੀ ਦੀ ਕੋਈ ਦਿੱਕਤ ਨਹੀਂ ਆਉਂਦੀ ਅਤੇ ਮੇਰਾ ਮਨਪਸੰਦ ਜੋ ਸਰਦੀਆਂ ਦੇ ਵਿੱਚ ਖਾਣ ਵਾਲਾ ਭੋਜਨ ਆ ਜਾਂ ਰੋਟੀ ਆ ਉਹ ਸਾਗ ਆ ਸਾਗ ਪੰਜਾਬ ਦਾ ਇੱਕ ਮਹੱਤਵਪੂਰਨ ਖਾਣਾ ਏ ਜੋ ਹਰੇਕ ਘਰ ਦੇ ਵਿੱਚ ਬਣਾਇਆ ਜਾਂਦਾ ਸ਼ਹਿਰ ਵਾਲਿਆਂ ਨੂੰ ਇਸ ਵਿੱਚ ਬਹੁਤ ਦਿੱਕਤ ਆਉਂਦੀ ਬਣਾਉਣ ਦੀ ਪਰ ਪਿੰਡਾਂ ਦੇ ਲੋਕਾਂ ਨੂੰ ਇਹ ਆਮ ਮਿਲ ਜਾਂਦਾ ਤੁਸੀਂ ਕਿੱਥੇ ਮਰਜ਼ੀ ਲੰਘ ਜਾਓ ਖੇਤਾਂ 'ਚੋਂ ਤੋੜ ਲਿਆਓ ਠੀਕ ਆ ਜੀ ਤੋੜ ਕੇ ਲਿਆ ਕੇ ਪਹਿਲਾਂ ਉਹਨੂੰ ਸਾਫ ਕਰੋ ਸਾਫ ਕਰਕੇ ਫਿਰ ਪਾਣੀ 'ਚ ਅੱਗ ਬਾਲੋ ਅੱਗ ਬਾਲ ਕੇ ਪਾਣੀ ਧਰੋ ਉਹਦੇ ਵਿੱਚ ਸਾਗ ਨੂੰ ਕੱਟ ਕੇ ਪਾਓ ਨਾਲ ਪਾਲਕ ਪਾਓ ਮੇਥੇ ਪਾਓ ਧਨੀਆ ਪਾਓ ਬਾਥੂ ਪਾਓ ਅਤੇ ਦੋ ਤਿੰਨ ਘੰਟੇ ਮਿਹਨਤ ਕਰਨ ਤੋਂ ਬਾਅਦ ਤਿੰਨ ਤੋਂ ਵੀ ਵੱਧ ਟਾਈਮ ਲੱਗ ਜਾਂਦਾ ਜੀ ਬਹੁਤ ਟਾਈਮ ਮਿਹਨਤ ਕਰਨ ਤੋਂ ਬਾਅਦ ਤੁਹਾਨੂੰ ਸਾਗ ਮਿਲਦਾ ਹੈ ਸਾਗ ਦੇ ਵਿੱਚ ਫਿਰ ਨਾਲ ਮੱਕੀ ਦੀ ਰੋਟੀ ਮੂਲੀ ਦੇ ਖਾਣ ਨਾਲ ਸਾਗ ਦਾ ਟੇਸਟ ਆਪਣਾ ਹੀ ਅਲੱਗ ਤੋਂ ਹੁੰਦਾ ਏ